ਹਾਂਜੀ ਭੰਗੜੇ ਬਾਰੇ ਨਾ ਗਲਤ ਧਾਰਨਾ ਇਹ ਹੈ ਵੀ ਕਈ ਲੋਕਾਂ ਦਾ ਇਹ ਸੋਚ ਹੁੰਦੀ ਹੈ ਵੀ ਭੰਗੜਾ ਸਿਰਫ਼ ਤਿਉਹਾਰ 'ਤੇ ਹੀ ਨਹੀਂ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਵੀ ਕੀਤਾ ਜਾਂਦਾ ਹੈ ਅਤੇ ਇਹ ਸਿਰਫ਼ ਨੱਚਣਾ ਕੁੱਦਣਾ ਹੀ ਨਹੀਂ ਹੁੰਦਾ ਅਤੇ ਉਸ ਵਿੱਚ ਅੱਡ ਅੱਡ ਤਰ੍ਹਾਂ ਦੇ ਐਲੀਮੈਂਟਸ ਹੁੰਦੇ ਹੈ ਹਾਵ ਭਾਵ ਹੁੰਦੇ ਹੈ ਅਤੇ ਇਹ ਸਿਰਫ਼ ਨਾ ਬੰਦਿਆਂ ਲਈ ਨਹੀਂ ਔਰਤਾਂ ਵੀ ਕਰ ਸਕਦੀਆਂ ਅਤੇ ਇਹ ਸਿਰਫ਼ ਢੋਲ 'ਤੇ ਹੀ ਨਹੀਂ ਅਤੇ ਮਿਊਜਿਕ 'ਤੇ ਬੀਟਸ 'ਤੇ ਵੀ ਪਾਇਆ ਜਾਂਦਾ ਅਤੇ ਹਰ ਹਰ ਇੱਕ ਜਾਤਪਾਤ ਦੇ ਇਸਨੂੰ ਕਰ ਸਕਦੇ ਹੈ ਅਤੇ ਇਹਦੇ ਅਲੱਗ ਅਲੱਗ ਧਾਰਨਾ ਦੇ ਕੇ ਅਤੇ ਇਸਨੂੰ ਹੱਲ ਕੀਤਾ ਜਾ ਸਕਦਾ ਧੰਨਵਾਦ